ਲੋਕਾਂ ਦਾ ਕੰਮ ਮੁੱਖ ਕਿੱਤਾ ਖੇਤੀਬਾੜੀ ਹੈ ਅੱਜ ਕੱਲ੍ਹ ਦੇ ਅੱਸੀ ਪ੍ਰਸੈਂਟ ਲੋਕ ਖੇਤੀਬਾੜੀ 'ਤੇ ਨਿਰਭਰ ਹੁੰਦੇ ਸਨ ਪੁਰਾਣੇ ਜਮਾਨੇ ਦੇ ਲੋਕ ਬਹੁਤ ਸਾਰੀਆਂ ਫ਼ਸਲਾਂ ਉਗਾਉਂਦੇ ਹਨ ਅਤੇ ਸਾਰਾ ਸਾਰਾ ਦਿਨ ਖੇਤਾਂ ਵਿੱਚ ਹੀ ਕੰਮ ਵਿੱਚ ਰੁੱਝੇ ਰਹਿੰਦੇ ਸੀ

ਉਹ ਦੇਸੀ ਖਾਦਾਂ ਨਾਲ ਹੀ ਫਸਲਾਂ ਉਗਾਉਂਦੇ ਸੀ ਅਤੇ ਬਹੁਤ ਤੰਦਰੁਸਤ ਵੀ ਰਹਿੰਦੇ ਸੀ ਇਸ ਕਰਕੇ ਸਾਰਾ ਸਾਰਾ ਦਿਨ ਹੀ ਖੇਤਾਂ ਵਿੱਚ ਕੰਮ ਕਰਦੇ ਰਹਿੰਦੇ ਸੀ ਪਰ ਅੱਜ ਕੱਲ੍ਹ ਦੇ ਲੋਕ ਬਹੁਤ ਹੀ ਰੇਹਾਂ ਸਪਰੇਹਾਂ ਕਰੀ ਜਾ ਰਹੇ ਸਨ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗ ਰਹੀਆਂ ਸਾਨੂੰ ਅੱਜ ਕੱਲ੍ਹ ਸਿਰਫ ਦੋ ਤਿੰਨ ਫਸਲਾਂ ਹੀ ਰਹਿ ਗਈਆਂ ਜਿਵੇਂ ਕਿ ਆਲੂ ਮਟਰ ਕਣਕ ਆਦ ਆਦਿ ਉਹ ਵੀ ਰੇਹਾਂ ਸਪਰੇਹਾਂ ਵਰਤੋਂ ਕਰਕੇ ਹੀ ਉਗਾਈਆਂ ਜਾਂਦੀਆਂ ਸਨ ਅੱਜ ਕੱਲ੍ਹ ਦੇ ਲੋਕ ਖੇਤੀਬਾੜੀ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਰਹਿ ਰਹੇ ਸਨ ਇਸਦਾ ਮੁੱਖ ਕਾਰਨ ਇਹ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਸਹੀ ਰੇਟ ਨਹੀਂ ਦਿੰਦੇ ਸਰਕਾਰ ਸਹੀ ਰੇਟ ਨਹੀਂ ਦਿੰਦੀ ਇਸ ਕਰਕੇ ਖੇਤੀ ਅਲੋਪ ਹੁੰਦੀ ਜਾ ਰਹੀ ਹੈ ਆਉਣ ਵਾਲੇ ਸਾਲਾਂ ਵਿੱਚ ਖੇਤੀ ਹਮੇਸ਼ਾ ਲਈ ਹੀ ਖ਼ਤਮ ਹੋਣ ਜਾ ਰਹੀ ਹੈ ਅੱਜ ਕੱਲ੍ਹ ਦੇ ਨੌਜਵਾਨ ਨੂੰ ਖੇਤੀ ਤੋਂ ਬਹੁਤ ਹਨ ਉਹਨਾਂ ਨੂੰ ਕੋਈ ਵੀ ਨੋਲੇਜ ਨਹੀਂ ਹੈ ਵੀ ਖੇਤੀਬਾੜੀ ਕੀ ਹੁੰਦੀ ਹੈ ਕਿੱਦਾਂ ਕੀਤੀ ਜਾਂਦੀ ਹੈ